ਬਰਤਨ ਧੋਣ ਦੀ ਪ੍ਰਕ੍ਰਿਆ ਬਹੁਤ ਹੀ ਸਰਲ ਹੈ ਅੱਜ ਕੱਲ੍ਹ ਘਰਾਂ ਵਿੱਚ ਅਲੱਗ ਅਲੱਗ ਤਰੀਕੇ ਦੇ ਬਰਤਨ ਇਸਤੇਮਾਲ ਕੀਤੇ ਜਾਂਦੇ ਹਨ ਕੁਛ ਮਿੱਟੀ ਦੇ ਭਾਂਡੇ ਯੂਜ ਕਰਦੇ ਹਨ ਕੁਛ ਲੋਕ ਕੱਚ ਦੇ ਇਸਤੇਮਾਲ ਕਰਦੇ ਹਨ ਕੁਛ ਲੋਕ ਪਿੱਤਲ ਦੇ ਭਾਂਡੇ ਵੀ ਯੂਜ ਕਰਦੇ ਹਨ ਜਿਹੜੇ ਕਿ ਪਹਿਲਾਂ ਦੇ ਸਮੇਂ 'ਤੇ ਵੀ ਲੋਕ ਇਸਤੇਮਾਲ ਕਰਦੇ ਸਨ ਅਤੇ ਉਹਨਾਂ ਦੇ ਬਹੁਤ ਸਾਰੇ ਫਾਇਦੇ ਵੀ ਸਨ ਇਸ ਲਈ ਇਹਨਾਂ ਸਾਰੇ ਬਰਤਨਾਂ ਨੂੰ ਮਾਂਜਣਾ ਦੇ ਲਈ ਕੁਛ ਅਲੱਗ ਤਰੀਕੇ ਦੀਆਂ ਚੀਜ਼ਾਂ ਦੀ ਲੋੜ ਵੀ ਪੈਂਦੀ ਹੈ ਕਈ ਵਾਰ ਆਪਾਂ ਆਸਾਨੀ ਨਾਲ ਇਹਨਾਂ ਨੂੰ ਸਾਫ ਕਰ ਸਕਦੇ ਹਾਂ ਸਾਨੂੰ ਨੋਰਮਲ ਸਾਰਿਆਂ ਨਾਲੋਂ ਪਹਿਲਾਂ ਬਰਤਨ ਸਾਫ ਕਰਨ ਲਈ ਉਹਨਾਂ ਨੂੰ ਇੱਕ ਵਾਰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਵਿੱਚ ਬਚਿਆ ਹੋਇਆ ਪਦਾਰਥ ਜੋ ਕਿ ਸਬਜ਼ੀ ਕੁਛ ਅੰਨ ਦੇ ਕਣ ਹੋ ਸਕਦੇ ਹਨ ਉਹਨਾਂ ਨੂੰ ਕੱਢਿਆ ਜਾ ਸਕਦਾ ਹੈ ਤਾਂ ਕਿ ਬਾਅਦ ਵਿੱਚ ਸਾਨੂੰ ਬਰਤਨ ਸਾਫ ਕਰਨ ਵਿੱਚ ਦਿੱਕਤ ਨਾ ਹੋਵੇ ਇਸ ਲਈ ਇਹ ਧੋਣ ਤੋਂ ਬਾਅਦ ਸਾਨੂੰ ਡਿਟਰਜੈਂਟ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਕੁਛ ਲੋਕ ਲਿਕੁਡ ਵਾਸ਼ ਯੂਜ ਕਰਦੇ ਹਨ ਕੁਛ ਲੋਕ ਸਾਬਣ ਦਾ ਇਸਤੇਮਾਲ ਕਰਦੇ ਹਨ ਅਤੇ ਪੁਰਾਣੇ ਸਮੇਂ 'ਤੇ ਲੋਕ ਮਿੱਟੀ ਦਾ ਵੀ ਇਸਤੇਮਾਲ ਕਰਦੇ ਸਨ ਸਵਾਹ ਦਾ ਇਸਤੇਮਾਲ ਕਰਦੇ ਸਨ ਤਾਂ ਕਿ ਬਰਤਨਾਂ ਨੂੰ ਚੰਗੀ ਤਰ੍ਹਾਂ ਚਮਕਾਇਆ ਜਾ ਸਕੇ ਸਾਨੂੰ ਇਹ ਨਾ ਸਾਰੀਆਂ ਚੀਜ਼ਾਂ ਦੇ ਵਿੱਚੋਂ ਜੋ ਤੁਹਾਨੂੰ ਸ ਸਹੀ ਲੱਗਦਾ ਹੈ ਜੋ ਤੁਹਾਡੇ ਘਰ ਵਿੱਚ ਇਸਤੇਮਾਲ ਹੁੰਦੀਆਂ ਹਨ ਉਹਨਾਂ ਨਾਲ ਤੁਸੀਂ ਬਰਤਨ ਨੂੰ ਚੰਗੀ ਤਰ੍ਹਾਂ ਮਾਂਜ ਸਕਦੇ ਹੋ ਫਿਰ ਉਸ ਤੋਂ ਬਾਅਦ ਬਰਤਨ ਨੂੰ ਮਾਂਜਣ ਤੋਂ ਬਾਅਦ ਠੰਡੇ ਪਾਣੀ ਨਾਲ ਇਹਨਾਂ ਨੂੰ ਧੋ ਲਿੱਤਾ ਜਾਵੇ ਤਾਂ ਕਿ ਬਰਤਨ ਵਧੀਆ ਚਮਕ ਜਾਣ ਅਤੇ ਵਧੀਆ ਤਰੀਕੇ ਨਾਲ ਸਾਫ ਕੀਤੇ ਜਾ ਸਕਣ ਤੇਲ ਵਾਲੇ ਬਰਤਨਾਂ ਨੂੰ ਸਾਫ ਕਰਨ ਲਈ ਸਾਨੂੰ ਗਰਮ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਸਾਨੂੰ ਇੱਦਾਂ ਦੇ ਬਰਤਨਾਂ ਨੂੰ ਸਾਫ ਕਰਨ ਲਈ ਗਰਮ ਪਾਣੀ ਲੈ ਕੇ ਉਹਦੇ ਵਿੱਚ ਬਰਤਨ ਨੂੰ ਚੰਗੀ ਤਰ੍ਹਾਂ ਹਿਲਾ ਕੇ ਆਸਾਨੀ ਨਾਲ ਹੱਥ ਨਾਲ ਸਾਫ ਕਰ ਲੈਣਾ ਚਾਹੀਦਾ ਤਾਂ ਕਿ ਉਹਦੇ ਵਿਚਲਾ ਚਿਕਣਾ ਪਦਾਰਥ ਬਾਹਰ ਕੱਢਿਆ ਜਾ ਸਕੇ ਫਿਰ ਉਸ ਦੇ ਵਿੱਚ ਸਾਬਣ ਲਗਾ ਕੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਾਫ ਕਰ ਸਕਦੇ ਹੋ ਅਤੇ ਸ ਨਾਰਮਲ ਠੰਡੇ ਪਾਣੀ ਨਾਲ ਵੀ ਜਾਂ ਕੋਸੇ ਪਾਣੀ ਨਾਲ ਤੁਸੀਂ ਉਹਨੂੰ ਫਿਰ ਦੁਬਾਰਾ ਤੋਂ ਪਾਣੀ 'ਚੋਂ ਕੱਢ ਸਕਦੇ ਹੋ ਤਾਂ ਕਿ ਬਰਤਨ ਆਸਾਨੀ ਨਾਲ ਸਾਫ ਕੀਤੇ ਜਾ ਸਕਣ